ਹੈਲੋ ਹਾਂਜੀ ਓਬਰ ਟੈਕਸੀ ਡਰਾਈਵਰ ਟੈਕਸੀ ਸਰਵਿਸ ਤੋਂ ਬੋਲ ਰਹੇ ਹੋ ਹਾਂਜੀ ਮੈਂ ਕੈਬ ਕੀਤੀ ਸੀ ਔਡਰ ਯੂ ਆਈ ਟੀ ਚੰਡੀਗੜ੍ਹ ਤੋਂ ਮੈਂ ਜਾਣਾ ਸੀ ਬੱਸ ਸਟੈਚ ਬੱਸ ਸਟੈਂਡ ਅਤੇ ਮੇਰਾ ਪਿੱਕਅਪ ਪੁਆਇੰਟ ਯੂ ਆਈ ਟੀ ਪੱਚੀ ਸੈਕਟਰ ਸੀ ਮੈਂ ਨੌ ਵਜੇ ਕਿਹਾ ਸੀ ਕਿ ਸਵਾ ਨੌ ਤੱਕ ਡਰਾਈਵਰ ਨੇ ਐਗਰੀ ਕੀਤਾ ਸੀ ਕਿ ਉਹ ਆ ਜਾਏਗਾ ਬਟ ਮੈਂ ਸਵਾ ਨੌ ਤੱਕ ਵੇਟ ਕੀਤੀ ਤਾਂ ਡਰਾਈਵਰ ਨਹੀਂ ਆਇਆ ਮੈਂ ਬਹੁਤ ਲੇਟ ਹੋ ਰਹੀ ਸੀ ਮੇਰੀ ਮੀਟਿੰਗ ਸੀ ਕੁਛ ਇੰਪੋਰਟੈਂਟ ਮੈਂ ਅੱਗੇ ਜਾਣਾ ਸੀ ਤਾਂ ਮੈਂ ਹੁਣ ਆਟੋ ਲੈ ਕੇ ਚਲੀ ਗਈ ਐ ਤਾਂ ਡਰਾਈਵਰ ਦਾ ਨਾ ਤਾਂ ਕੋਈ ਦਿਖਾ ਰਿਹਾ ਸੀ ਮੈਨੂੰ ਮੈਂ ਟਰੈਕ ਹੀ ਨਹੀਂ ਕਰ ਪਾ ਰਹੀ ਸੀ ਤੁਹਾਡੀ ਐਪ 'ਤੇ ਵੀ ਟਰੈਕ ਨਹੀਂ ਕਰ ਪਾ ਰਹੀ ਸੀ ਨਾ ਉਹ ਮੇਰਾ ਫੋਨ ਪਿੱਕ ਕਰ ਰਿਹਾ ਸੀ ਜਦੋਂ ਤੁਹਾਡੀ ਐਪ 'ਤੇ ਫੋਨ ਆ ਰਿਹਾ ਸੀ

ਤਾਂ ਮੇਰਾ ਡਰਾਈਵਰ ਨਹੀਂ ਪਹੁੰਚਿਆ ਅਤੇ ਹੁਣ ਜੇ ਉਹ ਪਹੁੰਚਦਾ ਤਾਂ ਮੈਂ ਉਸਦੀ ਪੇਮੈਂਟ ਪਲੀਜ਼ ਮੇਰੀ ਰੀਵਰਟ ਕੀਤੀ ਜਾਏ ਕਿਉਂਕਿ ਮੈਂ ਪੇਮੈਂਟ ਕਰ ਚੁੱਕੀ ਔਲਰੇਡੀ ਨੱਬੇ ਰੁਪਏ ਤਾਂ ਪਲੀਜ਼ ਉਹ ਰਿਵਰਡ ਬੈਕ ਕੀਤੀ ਜਾਏ ਕਿਉਂਕਿ ਮੈਂ ਬਹੁਤ ਹੈਰਾਸ ਹੋਈ ਆ ਇਸ ਕੇਸ 'ਚ ਨਾ ਮੈਂ ਤੁਹਾਡੀ ਕੈਬ ਔਡਰ ਕੀਤੀ ਅਤੇ ਤੁਸੀਂ ਪਹੁੰਚੇ ਹੀ ਨਹੀਂ ਉਹ ਡਰਾਈਵਰ ਪਹੁੰਚਿਆ ਹੀ ਨਹੀਂ ਉਦੋਂ ਤੱਕ ਠੀਕ ਹੈ ਪਲੀਜ਼ ਥੈਂਕ ਯੂ